ਮਤਲਬ ਮੈਨੂੰ ਲੱਗਦਾ ਕਿ ਆਨਲਾਈਨ ਪੇਮੈਂਟ ਨਾਲ ਇੱਕ ਤਾਂ ਪੇਮੈਂਟ ਛੇਤੀ ਹੋ ਜਾਂਦੀ ਹੈ ਤੁਹਾਨੂੰ ਕਿਤੇ ਬੈਂਕਾਂ ਦੇ ਵਿੱਚ ਲਾਈਨ 'ਚ ਨਹੀਂ ਲੱਗਣਾ ਪੈਂਦਾ ਹੈ ਨਾ ਇਹਦੇ ਫਾਇਦੇ ਵੀ ਹੈ ਫਾਇਦੇ ਮਤਲਬ ਤੁਹਾਨੂੰ ਲਾਈਨ ਦੇ ਚੱਕਰ 'ਚੋਂ ਬਚਣਾ ਬਚ ਜਾਂਦੇ ਤੁਸੀਂ ਤੁਹਾਡਾ ਟਾਈਮ ਕੰਜਮਸ਼ਨ ਘੱਟ ਜਾਂਦੀ ਹੈ ਤੁਹਾਡੀ ਪੇਮੈਂਟ ਆਨਲਾਈਨ ਸੇਫ ਹੋ ਜਾਂਦੀ ਹੈ ਅਤੇ ਤੁਹਾਡਾ ਮਤਲਬ ਜਿੱਦਾਂ ਕੇਸ ਜਿੱਦਾਂ ਕਹਿੰਦੇ ਵੀ ਆਨਲਾਈਨ ਠੱਗੀ ਅੱਜ ਕੱਲ੍ਹ ਬਹੁਤ ਹੋ ਰਹੀ ਹੈ ਜਦੋਂ ਤੁਸੀਂ ਗੂਗਲ ਤੋਂ ਕੋਈ ਨੰਬਰ ਲੈ ਕੇ ਅਤੇ ਤੁਸੀਂ ਉਂ ਉਹਨੂੰ ਕੰਪਨੀ ਨੂੰ ਫੋਨ ਲਗਾ ਦਿੰਦੇ ਹੋ ਹੈ ਨਾ ਅਤੇ ਜਿੱਦਾਂ ਦਸ ਸਾਡਾ ਇੱਕ ਕੇਸ ਸੀਗਾ ਅਤੇ ਉਹਨੇ ਸਕੂਟਰ ਬਾਏ ਕੀਤਾ ਅਤੇ ਜਦੋਂ ਉਹਨੇ ਸਕੂਟਰ ਬਾਏ ਕੀਤਾ ਅਤੇ ਉਹ ਕਹਿੰਦੇ ਜੀ ਤੁਹਾਡਾ ਸਕੂਟਰ ਆ ਗਿਆ ਹੈ ਨਾ ਅਤੇ ਆਨਲਾਈਨ ਪੇਮੈਂਟ ਕਰ ਦਿਓ ਅਸੀਂ ਬਾਹਰ ਹੀ ਖੜ੍ਹੇ ਹਾਂ ਉਹਨਾਂ ਨੇ ਆਨਲਾਈਨ ਪੇਮੈਂਟ ਕਰ ਦਿੱਤੀ ਅਤੇ ਜਦੋਂ ਉਹ ਕਹਿੰਦੇ ਜੀ ਸਾਡੇ ਕੋਲ ਤਾਂ ਪੇਮੈਂਟ ਪਹੁੰਚੀ ਨਹੀਂ ਅਤੇ ਉਹਨਾਂ ਨੇ ਉਹ ਕਹਿੰਦੇ ਸਾਨੂੰ ਇੰਨੇ ਵੀਹ ਹਜ਼ਾਰ ਰੁਪਿਆ ਹੋਰ ਭੇਜੋ ਉਹਨਾਂ ਨੇ ਹੋਰ ਭੇਜਤਾ ਕਰਦੇ ਕਰਦੇ ਉਹ ਫਿਰ ਇੱਕ ਇਹੀ ਕਹਿਣ ਕਹਿੰਦੇ ਅਸੀਂ ਤਾਂ ਬਾਹਰ ਖੜ੍ਹੇ ਹਾਂ ਤੁਹਾਡੀ ਪੇਮੈਂਟ ਸਾਡੇ ਕੋਲ ਆਈ ਨਹੀਂ ਉਹਨਾਂ ਨੇ ਫਿਰ ਵੀਹ ਹਜ਼ਾਰ ਕਰ ਦਿੱਤੀ ਮੁੜਕੇ ਜਦੋਂ ਦੋ ਤਿੰਨ ਵਾਰੀ ਪੇਮੈਂਟ ਕਰਦੀ ਅੱਸੀ ਹਜ਼ਾਰ ਦੀ ਪੇਮੈਂਟ ਚਲੀ ਗਈ ਅਤੇ ਫਿਰ ਉਹਨਾਂ ਨੇ ਫੋਨ ਹੀ ਬੰਦ ਕਰ ਦਿੱਤਾ ਅਤੇ ਉਹ ਬਾਹਰ ਦੇਖਣਗੇ ਵੀ ਸਕੂਟਰ ਹੈਗਾ ਕਿ ਨਹੀਂ ਹੈਗਾ ਸਕੂਟਰ ਓਥੇ ਕੋਈ ਵੀ ਨਹੀਂ ਸੀਗਾ ਉਹਨਾਂ ਨੇ ਬਿਨਾਂ ਦੇਖਿਆ ਬਿਨਾਂ ਸੋਚਿਆ ਕੋਈ ਬੈਂਕ ਤੋਂ ਉਹਨਾਂ ਨੂੰ ਕੋਈ ਫੋਨ ਨਹੀਂ ਸੀ ਆ ਰਿਹਾ ਕਿਸੇ ਨੰਬਰ ਤੋਂ ਹੀ ਆ ਰਿਹਾ ਸੀਗਾ ਉਹਨਾਂ ਨੇ ਧਿਆਨ ਨਹੀਂ ਦਿੱਤਾ ਬੀ ਇਹਦਾ ਬੈਂਕ ਦਾ ਕੋਈ ਹੈ ਹੀ ਨਹੀਂ ਸੀਗਾ ਹੈ ਨਾ ਇਹ ਚੀਜ਼ਾਂ ਦਾ ਧਿਆਨ ਕਿ ਤੁਹਾਨੂੰ ਕੋਈ ਫੋਨ ਆਵੇ ਜਾਂ ਕੋਈ ਮੈਸੇਜ ਆਵੇ ਤੁਸੀਂ ਉਹ ਬੈਂਕ ਤੋਂ ਆ ਰਿਹਾ ਕਿ ਪਰਸਨਲ ਕਿਸੇ ਨੰਬਰ ਤੋਂ ਆ ਰਿਹਾ ਇਸ ਚੀਜ਼ ਦਾ ਸਾਨੂੰ ਆਪ ਧਿਆਨ ਰੱਖਣਾ ਚਾਹੀਦਾ ਆ ਇਹੋ ਜਿਹੀਆਂ ਠੱਗੀਆਂ ਦਾ ਕਈ ਹੋ ਰਹੀਆਂ ਅੱਜ ਕੱਲ੍ਹ ਪਰ ਇਸ ਚੀਜ਼ ਦਾ ਧਿਆਨ ਸਾਨੂੰ ਆਪ ਰੱਖਣਾ ਚਾਹੀਦਾ